ਚੌਦ੍ਹਾਂ ਜੁਲਾਈ ਉੱਨੀ ਸੌ ਨੱਬੇ ਪੰਜ ਨਵੰਬਰ ਉੱਨੀ ਸੌ ਤ੍ਰਿਆਨਵੇਂ ਚੌਦ੍ਹਾਂ ਸਤੰਬਰ ਉੱਨੀ ਸੌ ਪਚਾਨਵੇਂ ਸੱਤ ਅਪ੍ਰੈਲ ਉੱਨੀ ਸੌ ਅਠਾਸੀ ਇੱਕ ਜੁਲਾਈ ਦੋ ਹਜ਼ਾਰ ਤੇਈ